ਯੋਗਾ ਯੋਗਾ ਸਰੀਰ ਦੇ ਲਈ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ ਅਤੇ ਇਹ ਤਾਂ ਹਰ ਵਿਅਕਤੀ ਨੂੰ ਕਰਨੀ ਚਾਹੀਦੀ ਹੈ ਅਤੇ ਯੋਗਾ ਕਰਨ ਦਾ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੀ ਸਮਾਂ ਹੁੰਦਾ ਹੈ ਕਿਉਂਕਿ ਸਵੇਰੇ ਸਵੇਰੇ ਤੁਸੀਂ ਯੋਗ ਕਰਦੇ ਹੋ ਤਾਂ ਤੁਸੀਂ ਇੱਕ ਸ਼ਾਂਤ ਮਹਿਸੂਸ ਦਿਮਾਗ ਨਾਲ ਕਰਦੇ ਹੋ ਜਿਸ ਦੇ ਨਾਲ ਤੁਸੀਂ ਇੱਕ ਵਧੀਆ ਨਵੇਂ ਤੋਂ ਨਵੇਂ ਆ ਆਈਡੀਆ ਜਿਹੜੇ ਅਸੀਂ ਸੋਚ ਸਕਦੇ ਅਨ ਅਤੇ ਆਪਣੀ ਲਾਈਫ ਦੀਆਂ ਪ੍ਰੋਬਲਮਾਂ ਨੂੰ ਵੀ ਹੀ ਸੋਲਵ ਕਰ ਸਕਦੇ ਹੋ ਯੋਗੇ ਰਾਹੀਂ ਤੁਸੀਂ ਆਪਣੇ ਸਰੀਰ ਦੀ ਇੱਕ ਅਲੱਗ ਤਾਕਤ ਜਿਹੜੀ ਹੈ ਅੰਦਰੂਨੀ ਤਾਕਤ ਮਾਨਸਿਕ ਤੌਰ 'ਤੇ ਅਤੇ ਅੰਦਰੂਨੀ ਤੌਰ 'ਤੇ ਤੁਸੀਂ ਜਿਹੜੇ ਕਿ ਤਾਕਤਵਰ ਹੁੰਦੇ ਹਨ ਅਗਰ ਤੁਸੀਂ ਦੌੜਦੇ ਹੋ ਕੋਈ ਗੇਮ ਕਰਦੇ ਹੋ ਜਾਂ ਕੁਛ ਵੀ ਗੇ ਖੇਡਦੇ ਹੋ ਤਾਂ ਤੁਸੀਂ ਇੱਕ ਸਰੀਰਕ ਪੱਖੋਂ ਕਮਜ਼ੋਰ ਤਾਂ ਨਹੀਂ ਰਹਿੰਦੇ ਮਤਲਬ ਤਾਕ ਸਰੀਰ ਪੱਖੋਂ ਤਾਕਤਵਰ ਤਾਂ ਜ਼ਰੂਰ ਬਣਦੇ ਹੋ ਪਰ ਤੁਹਾਨੂੰ ਮਾਨਸਿਕ ਅਤੇ ਅੰਦਰੂਨੀ ਤੌਰ 'ਤੇ ਤਾਕਤਵਰ ਬਣਨ ਲਈ ਯੋਗਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਤੁਹਾਡੀ ਮਾਨਸਿਕ ਤਾਕਤ ਅਤੇ ਅੰਦਰੂਨੀ ਨਸਾਂ ਜਿਹੜੀਆਂ ਹੈ ਇੱਕ ਅਲੱਗ ਮਹਿਸੂਸ ਤਾਕਤ ਇੱਕ ਅਲੱਗ ਤਾਕਤ ਮਹਿਸੂਸ ਕਰਦੀਆਂ ਹਨ ਜਿਸ ਵਿੱਚ ਜਿਸ ਨਾਲ ਤੁਸੀਂ ਤੁਹਾਡਾ ਪਾਚਨ ਤੰਤਰ ਤੁਹਾਡੇ ਸਰੀਰ ਦੇ ਵੱਖ ਅੰਗ ਜਿਹੜੇ ਕਿ ਸਈ ਤੌਰ 'ਤੇ ਕੰਮ ਕਰਦੇ ਹਨ ਜਿਸ ਤਰ੍ਹਾਂ ਤੁਹਾਨੂੰ ਕੋਈ ਵੀ ਬਿਮਾਰੀ ਜਿਹੜੀ ਹੈ ਛੂਹ ਨਹੀਂ ਸਕਦੀ ਯੋਗੇ ਰਾਹੀਂ ਯੋਗਾ ਰਾਹੀਂ ਤੁਹਾਡੀ ਜਿਹੜੀ ਹੈ ਹਾਈਟ ਵਧਣਾ ਤੁਹਾਡੇ ਨਵੇਂ ਨਵੇਂ ਆਈਡੀਆ ਅਤੇ ਤੁਹਾਡਾ ਇੱਕ ਚਿਹਰੇ 'ਤੇ ਨੂ ਅਲੱਗ ਨੂਰ ਜਿਹੜਾ ਦਿਖਾਈ ਦਿੰਦਾ ਹੈ ਅਤੇ ਯੋਗ ਰਾਹੀਂ ਯੋਗ ਕਰਨ ਰਾਹੀਂ ਤੁਸੀਂ ਇੱਕ ਅਲੱਗ ਪਰਸਨੈਲਿਟੀ ਜਿਹੜੀ ਹੈ ਤੁਹਾਡੀ ਤਿਆਰ ਹੋ ਜਾਂਦੀ ਹੈ ਜਿਸ ਤਰ੍ਹਾਂ ਤੁਹਾਡੀ ਇੱਕ ਸਮਾਜ ਵਿੱਚ ਇੱਕ ਅਲੱਗ ਪਛਾਣ ਹੁੰਦੀ ਹੈ ਯੋਗ ਰਾਹੀਂ ਤੁਸੀਂ ਆਪਣੇ ਸਰੀਰ ਨੂੰ ਬਿਹਤਰ ਅਤੇ ਇੱਕ ਤੰਦਰੁਸਤ ਸਰੀਰ ਅੰਦਰੂਨੀ ਤੌਰ 'ਤੇ ਵੀ ਬਿਹਤਰ ਬਣਾ ਸਕਦੇ ਹੋ ਯੋਗਾ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਸ ਨਾਲ ਤੁਸੀਂ ਆਪਣੇ ਅੰਦਰੂਨੀ ਅਤੇ ਬਾਹਰੀ ਸਰੀਰ ਦੋਨਾਂ ਨੂੰ ਤੁਸੀਂ ਮਜ਼ਬੂਤ ਕਰ ਸਕਦੇ ਹੋ ਅਤੇ ਜੋ ਕਰਨ ਲਈ ਸਭ ਤੋਂ ਵਧੀਆ ਸਮਾਂ ਸਵੇਰ ਦਾ ਸਮਾਂ ਜੋ ਤੁਸੀਂ ਸਾਰੇ ਹੀ ਜਾਣਦੇ ਹੋ ਪਿੰਡਾਂ ਦੇ ਲੋਕ ਵੀ ਜਿਹੜੇ ਹੈ ਕਿ ਸ਼ਹਿਰ ਦੇ ਹੁਣ ਤਾਂ ਸ਼ਹਿਰਾਂ ਦੇ ਲੋਕਾਂ 'ਚ ਵੀ ਇਸ ਦਾ ਕਰੇਜ ਹੈ ਅਤੇ ਸਾਡੀ ਸਰਕਾਰ ਦੁਆਰਾ ਵੀ ਯੋਗਾ ਕਰਾਉਣ ਲਈ ਅਲੱਗ ਅਲੱਗ ਸਕੀਮਾਂ ਅਤੇ ਟੀਚਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਿਸ ਨਾਲ ਜਿਹੜੀ ਲੋਕਾਂ ਦੀ ਸਿਹਤ ਜਿਹੜੀ ਹੈ ਉਹ ਵਧੀਆ ਰਹੇ ਕਿਉਂਕਿ ਅੱਜ ਕੱਲ੍ਹ ਦਾ ਖਾਣ ਪੀਣ ਦੇ ਵਿੱਚ ਬਦਲਾਅ ਆਉਣ ਕਾਰਨ ਜਿਸ ਤਰ੍ਹਾਂ ਸਰੀਰ ਦੇ ਵਿੱਚ ਕਾਫ਼ੀ ਕਮਜ਼ੋਰੀਆਂ ਮਹਿਸੂਸ ਹੁੰਦੀਆਂ ਹਨ ਅਤੇ ਛੋਟੀ ਉਮਰਾਂ ਵਿੱਚ ਹੀ ਕਈ ਬੱਚਿਆਂ ਨੂੰ ਬੜੀਆਂ ਬੜੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਇਸ ਬਿਮਾਰੀਆਂ ਨੂੰ ਬਚਾਅ ਲਈ ਜਾਂ ਇਨ੍ਹਾਂ ਬੱਚਿਆਂ ਨੂੰ ਤੰਦਰੁਸਤ ਬਣਾਉਣ ਲਈ ਸਰਕਾਰ ਦੁਆਰਾ ਵੱਖ ਵੱਖ ਨੀਤੀਆਂ ਵੀ ਜਿਹੜੀਆਂ ਚਲਾਈਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਸਿਹਤ ਬਣਾਉਣ ਲਈ ਯੋਗਾ ਅਤੇ ਉਨ੍ਹਾਂ ਲਈ ਅਲੱਗ ਅਲੱਗ ਕੰਪਲੈਕਸ ਜਿਹੜੇ ਹੈ ਬਣਾਏ ਗਏ ਹਨ ਜਿਸ ਨਾਲ ਉਹ ਇੱਕ ਵਧੀਆ ਜ਼ਿੰਦਗੀ ਅਤੇ ਸਿਹਤ ਭਰੀ ਜ਼ਿੰਦਗੀ ਜੀਅ ਸਕਣ